ਯੋਗਾ ਅਭਿਆਸ ਵਿੱਚ ਸਾਨੂੰ ਸਰੀਰਕ ਜਾਂ ਮਾਨਸਿਕ ਚੁਣੌਤੀਆਂ ਦਾ ਅਨੁਭਵ ਹੁੰਦਾ ਹੈ ਅਤੇ ਇਹ ਸਪਸ਼ਟ ਤੌਰ 'ਤੇ ਯੋਗੀ ਦੇ ਮਾਰਗ ਵਿੱਚ ਇੱਕ ਰੁਕਾਵਟ ਹੈ ਕਿਉਂਕਿ ਇਹ ਮਨ ਨੂੰ ਵਾਰ ਵਾਰ ਭੌਤਿਕ ਸਰੀਰਕ ਵੱਲ ਖਿੱਚਦਾ ਹੈ ਅਤੇ ਇਸ ਨੂੰ ਅੰਦਰ ਵੱਲ ਸੇਧਿਤ ਕਰਨਾ ਮੁਸ਼ਕਿਲ ਬਣਾਉਂਦਾ ਹੈ ਨਿਰਸਤਾ ਸੁਸਤੀ ਕਮਜ਼ੋਰੀ ਡੁੱਬਣ ਵਾਲੀ ਸਥਿਤੀ ਕੁਝ ਲੋਕਾਂ ਦਾ ਸਰੀਰਕ ਸਰੀਰ ਜਾਹਰ ਤੌਰ 'ਤੇ ਸਿਹਤਮੰਦ ਹੁੰਦਾ ਹੈ ਪਰ ਉਹਨਾਂ ਵਿੱਚ ਦਿਮਾਗੀ ਸ਼ਕਤੀ ਦੀ ਘਾਟ ਹੁੰਦੀ ਹੈ ਤਾਂ ਜੋ ਉਹ ਹਮੇਸ਼ਾ ਬਰਾਬਰ ਮਹਿਸੂਸ ਕਰਦੇ ਹਨ ਅਤੇ ਲੰਬੇ ਸਮੇਂ ਤੱਕ ਮਿਹਨਤ ਦੀ ਲੋੜ ਵਾਲੇ ਕਿਸੇ ਵੀ ਕੰਮ ਨੂੰ ਕਰਨ ਲਈ ਅਸੰਤੁਸ਼ਟ ਮਹਿਸੂਸ ਕਰਦੇ ਹਨ ਇਹ ਗੰਭੀਰ ਥਕਾਵਟ ਬਹੁਤ ਸਾਰੇ ਮਾਮਲਿਆਂ ਵਿੱਚ ਮੂਲ ਰੂਪ ਵਿੱਚ ਮਨੋਵਿਗਿਆਨਿਕ ਹੈ ਅਤੇ ਜੀਵਨ ਵਿੱਚ ਕਿਸੇ ਨਿਸ਼ਚਿਤ ਅਤੇ ਗਤੀਸ਼ੀਲ ਉਦੇਸ਼ ਦੀ ਅਣਹੋਂਦ ਕਾਰਨ ਹੈ ਦੂਜੇ ਮਾਮਲਿਆਂ ਵਿੱਚ ਇਹ ਪਰਿਣਾਮ ਕੋਸ਼ ਵਿੱਚ ਕੁਝ ਨੁਕਸ ਕਾਰਨ ਹੁੰਦਾ ਹੈ ਅਤੇ ਜਿਸ ਦੇ ਨਤੀਜੇ ਵਜੋਂ ਭੌਤਿਕ ਸਰੀਰ ਨੂੰ ਮਹੱਤਵਪੂਰਨ ਸ਼ਕਤੀ ਦੀ ਨਾ ਕਾਫੀ ਸਿਕਪਲਾਈ ਹੁੰਦੀ ਹੈ ਇਸ ਦਾ ਕਾਰਨ ਜੋ ਵੀ ਹੋਵੇ ਇਹ ਇੱਕ ਰੁਕਾਵਟ ਦੇ ਰੂਪ ਵਿੱਚ ਕੰਮ ਕਰਦਾ ਹੈ ਕਿਉਂਕਿ ਇਹ ਸਾਧਨਾ ਦੇ ਅਭਿਆਸ ਦੇ ਸਾਰੇ ਯਤਨਾਂ ਨੂੰ ਕਮਜ਼ੋਰ ਕਰਦਾ ਹੈ ਸੰਦੇਹ ਯੋਗਾ ਦੀ ਪ੍ਰਭਾਵਸ਼ੀਲਤਾ ਅਤੇ ਇਸਦੇ ਤਰੀਕਿਆਂ ਵਿੱਚ ਇੱਕ ਅਟੁੱਟ ਵਿਸ਼ਵਾਸ ਇਸ ਦੇ ਸਫ਼ਲ ਅਭਿਆਸ ਲਈ ਇੱਕ ਜ਼ਰੂਰੀ ਗੱਲ ਹੈ ਕੋਸ਼ਿਸ਼ ਦੀ ਕਿਸੇ ਵੀ ਲਾਈਨ ਵਿੱਚ ਸਫ਼ਲਤਾ ਪ੍ਰਾਪਤ ਕਰਨ ਲਈ ਅਜਿਹੇ ਵਿਸ਼ਵਾਸ ਦੀ ਜ਼ਰੂਰਤ ਹੁੰਦੀ ਹੈ ਪਰ ਇਸ ਤੋਂ ਵੀ ਵੱਧ ਇਸ ਲਾਈਨ ਵਿੱਚ ਪੁੰਨ ਅਜੀਬ ਸਥਿਤੀਆਂ ਕਾਰਨ ਯੋਗੀ ਨੂੰ ਕੰਮ ਕਰਨਾ ਪੈਂਦਾ ਹੈ ਦੇਵੀ ਸਾਹਸ ਵਿੱਚ ਜੋ ਉਸਨੇ ਉਦੇਸ਼ ਲਿਆ ਹੈ ਅਣਜਾਣ ਹੈ ਅਤੇ ਕੋਈ ਸਪੱਸ਼ਟ ਤੌਰ 'ਤੇ ਪਰਿਭਾਸ਼ਿਤ ਮਾਪਦੰਡ ਨਹੀਂ ਹਨ